ਹਾਂਜੀ ਮੈਨੂੰ ਖਾਣਾ ਬਣਾਉਣਾ ਬਹੁਤ ਹੀ ਚੰਗਾ ਲੱਗਦਾ ਵਾ ਮੈਂ ਬਚਪਨ ਤੋਂ ਹੀ ਖਾਣਾ ਬਣਾਉਣ ਦਾ ਮੈਨੂੰ ਬਹੁਤ ਹੀ ਸ਼ੌਂਕ ਸੀ ਮੇਰੀ ਮੰਮਾ ਨੇ ਮੈਨੂੰ ਖਾਣਾ ਬਣਾਉਣਾ ਸ ਬਹੁਤ ਹੀ ਸੁਚੱਜੇ ਢੰਗ ਨਾਲ ਸਿਖਾਇਆ ਵਾ ਮਤਲਬ ਕਿ ਜਦੋਂ ਉਹ ਬਿਮਾਰ ਹੁੰਦੇ ਸੀ ਮੈਂ ਆਪਣਾ ਖਾਣਾ ਖੁਦ ਹੀ ਬਣਾਉਂਦੀ ਹੁੰਦੀ ਸੀ ਅਤੇ ਉਹ ਵੀ ਜਦੋਂ ਮੈਂ ਖਾਣਾ ਬਣਾਉਂਦੀ ਹੁੰਦੀ ਸੀ ਅਤੇ ਉਹ ਮੇਰੀ ਤਾਰੀਫ ਕਰਦੇ ਹੁੰਦੇ ਸੀ ਵੀ ਖਾਣਾ ਬਹੁਤ ਹੀ ਸਵਾਦ ਬਣਿਆ ਵਾ ਅਤੇ ਮਤਲਬ ਕਿ ਜਿਹੜਾ ਵੀ ਚੀਜ਼ ਮੈਂ ਬਣਾਉਂਦੀ ਸੀ ਅਤੇ ਉਹ ਸਾਰੇ ਹੀ ਕਹਿੰਦੇ ਹੁੰਦੇ ਸੀ ਪਰਿਵਾਰ ਕਹਿੰਦਾ ਹੁੰਦਾ ਸੀ ਵੀ ਤੁਹਾਡੇ ਹੱਥ ਦਾ ਬਣਿਆ ਜਿਹੜਾ ਖਾਣਾ ਵਾ ਬਹੁਤ ਹੀ ਸਵਾਦ ਬਣਿਆ ਵਾ ਮਤਲਬ ਕਿ ਹਰੇਕ ਚੀਜ਼ ਜਿਹੜੀ ਵੀ ਚੀਜ਼ ਉਹ ਕਹਿੰਦੇ ਹੁੰਦੇ ਸੀ ਉਹ ਵੀ ਮੈਂ ਬਣਾਉਂਦੀ ਹੁੰਦੀ ਸੀ ਵੀ ਉਹ ਕਹਿੰਦੇ ਹੁੰਦੇ ਵੀ ਜਿਹੜਾ ਵੀ ਤੁਸੀਂ ਖਾਣਾ ਬਣਾਉਂਦੇ ਹੋ ਬਹੁਤ ਹੀ ਜ਼ਿਆਦਾ ਸਵਾਦ ਬਣਦਾ ਵਾ ਅਤੇ ਮੈਨੂੰ ਖਾਣਾ ਬਣਾਉਣ ਦਾ ਬਹੁਤ ਹੀ ਸ਼ੌਂਕ ਸੀ ਅਤੇ ਇਹ ਮੈਂ ਆਪਣਾ ਸ਼ੌਂਕ ਜਿਹੜਾ ਸੀ ਪੀ ਮੇਰੇ ਮਨ ਦੇ ਵਿੱਚ ਇਹ ਸੀ ਕਿ ਮੈਂ ਆਪਣਾ ਸ਼ੌਂਕ ਜਿਹੜਾ ਵਾ ਇਹ ਪੂਰਾ ਕਰਾਂ ਮਤਲਬ ਕਿ ਜਿਹੜਾ ਵੀ ਮੈਨੂੰ ਕਵੇ ਵੀ ਮੈਂ ਖਾ ਜਿਹੜਾ ਵੀ ਜੋ ਵੀ ਕਵੇ ਮੈਂ ਉਸੇ ਖਾਣਾ ਆ ਜਿਹੜਾ ਵੀ ਖਾਣਾ ਬਣਾਉਂਦੀ ਸੀ ਉਹ ਸ ਬਹੁਤ ਹੀ ਵਧੀਆ ਬਣਦਾ ਸੀ ਅਤੇ ਮੇਰੇ ਪਰਿਵਾਰ ਦੀ ਇਹ ਪ੍ਰਕਿਰਿਆ ਸੀ ਕਿ ਉਹ ਇਹ ਕਹਿੰਦੇ ਸੀ ਵੀ ਤੂੰ ਆਪਣਾ ਰੁਜ਼ਗਾਰ ਜਿਹੜਾ ਵਾ ਉਹ ਕਰ ਸਕਦੀ ਹਾਂ ਜਦੋਂ ਵੀ ਮੈਂ ਕੋਈ ਖਾਣਾ ਬਣਾਉਂਦੀ ਸੀ ਉਹ ਮੈਨੂੰ ਮੇਰੇ ਖਾਣੇ ਦੀ ਤਾਰੀਫ ਕਰਦੇ ਸੀ ਜਿੱਦਾਂ ਵੀ ਹੋ ਖਾਣੇ ਦੀ ਤਰੀਫ ਉਹ ਕਹਿੰਦੇ ਵੀ ਤੂੰ ਆਪਣਾ ਰੁਜ਼ਗਾਰ ਜਿਹੜਾ ਵਾ ਚਲਾ ਸਕਦੀ ਹਾਂ ਜਿੱਦਾਂ ਵੀ ਸ਼ਹਿਰਾਂ ਤੋਂ ਬੱਚੇ ਜਿਹੜੇ ਆ ਇਹ ਪਿੰਡਾਂ ਤੋਂ ਬੱਚੇ ਜਿਹੜੇ ਸ਼ ਏ ਏ ਪੜ੍ਹਨ ਲਈ ਆਉਂਦੇ ਆ ਉਹਨਾਂ ਨੂੰ ਮਤਲਬ ਕਿ ਬਾਹਰ ਦਾ ਖਾਣਾ ਨਹੀਂ ਚੰਗਾ ਲੱਗਦਾ ਉਹ ਘਰ ਦਾ ਖਾਣਾ ਹੀ ਖਾਣਾ ਪਸੰਦ ਕਰਦੇ ਇਸ ਲਈ ਮੈਂ ਉਹਨਾਂ ਲਈ ਟਿਫਨ ਲਾਏ ਹੋਏ ਆ ਉਹ ਮੈਂ ਟਿਫਨ ਬਣਾ ਕੇ ਉਹਨਾਂ ਦੇ ਤੱਕ ਪਹੁੰਚਾ ਦਿੰਦੀ ਹਾਂ ਉਹ ਵੀ ਮੇਰੇ ਖਾਣੇ ਦੀ ਬਹੁਤ ਹੀ ਤਾਰੀਫ ਕਰਦੇ ਹਨ ਅਤੇ ਇਸ ਲਈ ਮੈਨੂੰ ਖਾਣਾ ਬਣਾਉਣਾ ਬਹੁਤ ਹੀ ਚੰਗਾ ਲੱਗਦਾ ਵਾ ਮੈਨੂੰ ਕੋਈ ਔਖਾ ਨਹੀਂ ਲੱਗਦਾ ਖਾਣ ਜਿਹੜੇ ਵੀ ਬੱਚੇ ਉਹ ਮੇਰਾ ਖਾਣਾ ਖਾਂਦੇ ਹਨ ਉਹ ਵੀ ਮੇਰੀ ਬਹੁਤ ਹੀ ਤਾਰੀਫ ਕਰਦੇ ਹਨ ਖਾਣੇ ਦੀ